ਸਤਿ ਸ਼੍ਰੀ ਅਕਾਲ ਜੀ ਮੈਂ ਐਮਾਜੋਨ ਦੀ ਸਾਈਡ ਤੋਂ ਨਾ ਇੱਕ ਈ ਈਅਰਬਡ ਆਰਡਰ ਕੀਤਾ ਸੀ ਅਤੇ ਉਹ ਈਅਰਬਡ ਕਾਫੀ ਵਧੀਆ ਕੁਆਲਿਟੀ ਦਾ ਨਿਕਲਿਆ ਅਤੇ ਮੈਨੂੰ ਪਹਿਲਾਂ ਇਹ ਡਰ ਜਿਹਾ ਡਰ ਜਿਹਾ ਸੀਗਾ ਵੀ ਆਨਲਾਈਨ ਜਿਵੇਂ ਆਪਾਂ ਕੋਈ ਚੀਜ਼ ਮੰਗਾਉਂਦੇ ਹਾਂ ਤਾਂ ਉਹ ਉਹੀ ਸੇਮ ਪ੍ਰੋਡਕਟ ਉਹਦੇ ਵਿੱਚ ਆਊਗਾ ਜਾਂ ਨਹੀਂ ਆਊਗਾ ਅਤੇ ਉਹਦੀ ਕੁਆਲਿਟੀ ਕਿਵੇਂ ਹੋਊਗੀ ਉਹ ਸਹੀ ਤਰੀਕੇ ਨਾਲ ਚੱਲੂਗਾ ਜਾਂ ਕੰਮ ਕਰੂਗਾ ਜਾਂ ਨਹੀਂ ਕਰੂਗਾ ਅਤੇ ਵਾਰੰਟੀ ਗਾਰੰਟੀ ਦਾ ਵੀ ਮੈਨੂੰ ਉਹਦੇ 'ਚ ਪੂਰਾ ਡਾਊਟ ਸੀ ਲੇਕਿਨ ਫਿਰ ਉਹ ਜਿਵੇਂ ਪ੍ਰੋਡਕਟ ਆਇਆ ਅਤੇ ਮੇਰੇ ਹੱਥ ਤੋਂ ਇੱਕ ਵਾਰੀ ਥੱਲੇ ਡਿੱਗ ਵੀ ਪਿਆ ਅਤੇ ਥੋੜ੍ਹੀ ਜਿਹੀ ਉਹਦੇ 'ਚ ਆਵਾਜ਼ ਜਿਹੀ ਆਉਣ ਲੱਗੀ ਉਹਦੇ ਬਾਅਦ ਮੈਂ ਉਹਨੂੰ ਰਿਪਲੇਸ ਕੀਤਾ ਅਤੇ ਮੇਰਾ ਫੁੱਲ ਰਿਪਰੇਸਮੈਂਟ ਉਹਨਾਂ ਨੇ ਕੰਪਨੀ ਨੇ ਕਰਕੇ ਦਿੱਤਾ ਅਤੇ ਪੂਰਾ ਮੇਰਾ ਪ੍ਰੋਡਕਟ ਨਵਾਂ ਹੀ ਫਿਰ ਮੈਨੂੰ ਦੁਬਾਰੇ ਮਿਲਿਆ ਅਤੇ ਉਹ ਵਧੀਆ ਚੱਲਿਆ ਵਧੀਆ ਚੱਲਿਆ ਅਤੇ ਫਿਰ ਮੈਂ ਇੰਸਪਾਇਰ ਹੋ ਗਿਆ ਫਿਰ ਮੈਂ ਹੋਰ ਲੋਕਾਂ ਨੂੰ ਵੀ ਦੱਸਿਆ ਅਤੇ ਹੋਰ ਮੇਰੇ ਕਹਿਣ 'ਤੇ ਮੇਰੇ ਯਾਰਾਂ ਦੋਸਤਾਂ ਨੇ ਵੀ ਉਹ ਸੇਮ ਪ੍ਰੋਡਕਟ ਆਰਡਰ ਕੀਤਾ ਲੇਕਿਨ ਫਿਰ ਉਹਨਾਂ ਦਾ ਜਿਹੜਾ ਅ ਈਅਰਬਡ ਆਏ ਸੀ ਚਾਰ ਪੰਜ ਆਰਡਰ ਅਸੀਂ ਕੀਤੇ ਸੀ ਦੂਜੀ ਵਾਰੀ ਅਤੇ ਉਹ ਸਾਰੇ ਹੀ ਮਤਲਬ ਸਹੀ ਨਹੀਂ ਨਿਕਲੇ ਅਤੇ ਸਾਰਿਆਂ ਦੇ ਵਿੱਚ ਵੀ ਕੋਈ ਨਾ ਕੋਈ ਨੁਕਸ ਸੀਗਾ ਅਤੇ ਚੱਲੇ ਨਹੀਂ ਉਹ ਉਹਦੇ ਬਾਅਦ ਰਿਪਲੇਸਮੈਂਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਕੰਪਨੀ ਨੇ ਉਹਨਾਂ ਨੂੰ ਰਿਪਲੇਸ ਨਹੀਂ ਕੀਤਾ ਅਤੇ ਪਹਿਲਾ ਆਰਡਰ ਤਾਂ ਮੇਰਾ ਬਾਹਲਾ ਵਧੀਆ ਸੀ ਉਹਦੇ ਕਰਕੇ ਮੈਂ ਦੂਜੇ ਓਡਰ ਦੇ ਬੈਠਿਆ ਲੇਕਿਨ ਉਹ ਦੂਜੇ ਪ੍ਰੋਡਕਟ ਉਹਦੇ ਜਮਾਂ ਹੀ ਸਹੀ ਨਹੀਂ ਨਿਕਲੇ